ਸਾਡੇ ਪਿੰਡ ਵਿੱਚ ਕਾਫੀ ਕੰਮ ਇਸ ਤਰ੍ਹਾਂ ਦੇ ਨੇ ਜਿਹੜੇ ਕੀਤੇ ਜਾਂਦੇ ਨੇ ਜਿਹਨਾਂ ਦਾ ਬਿਜਨਸ ਬਹੁਤ ਅੱਛਾ ਚੱਲ ਸਕਦਾ ਅਤੇ ਚੱਲ ਵੀ ਰਿਹਾ ਹੈ ਉਹਨਾਂ ਵਿੱਚੋਂ ਦੋ ਖਾਸ ਨੇ ਹੱਥ ਦੀ ਬਣੀ ਜੁੱਤੀ ਅਤੇ ਤੋਸ਼ਾ ਤੋਸ਼ਾ ਇੱਕ ਮਿਠਾਈ ਹੈ ਜਿਹੜੀ ਕਿ ਬਹੁਤ ਲੋਕ ਪਸੰਦ ਕਰਦੇ ਨੇ ਅਤੇ ਕਾਫੀ ਆਸੇ ਪਾਸੇ ਦੇ ਸ਼ਹਿਰਾਂ ਪਿੰਡਾਂ ਵਿੱਚ ਇਹਨੂੰ ਲੈ ਕੇ ਇਹਦਾ ਬਿਜਨਸ ਵੀ ਕੀਤਾ ਜਾਂਦਾ ਜਿਹਦੀਆਂ ਕਿ ਬਰਾਂਚ ਅੱਗੇ ਤੱਕ ਦਿੱਤੀਆਂ ਗਈਆਂ ਨੇ ਅਤੇ ਇਹ ਪੂਰੇ ਪੰਜਾਬ ਵਿੱਚ ਬਹੁਤ ਫੇਮਸ ਨੇ ਜੁੱਤੀ ਅਲੱਗ ਅਲੱਗ ਤਰ੍ਹਾਂ ਦੀ ਜੁੱਤੀ ਬਣਦੀ ਹੈ ਅਲੱਗ ਅਲੱਗ ਡਿਜ਼ਾਈਨ ਕਢਾਈ ਦੇ ਵਾਲੀ ਜੁੱਤੀ ਤਿਲੇ ਵਾਲੀ ਜੁੱਤੀ ਪੇਂਟ ਵਾਲੀ ਜੁੱਤੀ ਤਿੱਲੇ ਦੀ ਜੁੱਤੀ ਜਿਹਨਾਂ ਦਾ ਬਿਜ਼ਨਸ ਬਾਹਰ ਇੰਡੀਆ ਤੋਂ ਬਾਹਰ ਵੀ ਪੰਜਾਬ ਤੋਂ ਬਾਹਰ ਵੀ ਜਾਂਦਾ ਹੈ ਅਤੇ ਲੋਕ ਇਸ ਦਾ ਚੰਗਾ ਬਿਜਨਸ ਕਰ ਰਹੇ ਨੇ ਚੰਗੀ ਕਮਾਈ ਦਾ ਕੰਮ ਸਾਧਨ ਵੀ ਹੈ ਅਤੇ ਲੋਕ ਬਹੁਤ ਇਹਨਾਂ ਨੂੰ ਐਪਰੀਸ਼ੀਏਟ ਕਰਦੇ ਨੇ ਅਤੇ ਪਸੰਦ ਕਰਦੇ ਨੇ ਅਤੇ ਇਹ ਚੀਜ਼ਾਂ ਸਾਡੇ ਪਿੰਡ ਦੀਆਂ ਬੜੀਆਂ ਮਸ਼ਹੂਰ ਨੇ

ਤੋਸ਼ਾ ਇੱਕ ਅੱਛੀ ਮਿਠਾਈ ਹੈ ਥੈਂਕ ਯੂ